ਹਾਂਜੀ ਸਾਡੇ ਖੇਤਰ ਵਿੱਚ ਨਾ ਬਹੁਤ ਹੀ ਰਿਆਇਤੀ ਤਿਉਹਾਰ ਮਨਾਏ ਜਾਂਦੇ ਹਨ ਹੁਣੇ ਹੁਣੇ ਦੀਵਾਲੀ ਗਈ ਹੈ ਦੀਵਾਲੀ ਵਿੱਚ ਲੋਕੀ ਸਫ਼ਾਈਆਂ ਕਰਦੀ ਕਰਦੇ ਹਨ ਮਿਠਾਈਆਂ ਵਗੈਰਾ ਲਾਉਂਦੇ ਹਨ ਇੱਕ ਦੂਜੇ ਨੂੰ ਗਿਫਟ ਦਿੰਦੇ ਹਨ ਫਿਰ ਇਹ ਕਿਆ ਕਹਿੰਦੇ ਕਿ ਬੱਚਿਆਂ ਨੂੰ ਵੀ ਪਟਾਖੇ ਵਗੈਰਾ ਹੈ ਨਾ ਨਵੇਂ ਨਵੇਂ ਕੱਪੜੇ ਬੱਚਿਆਂ ਨੂੰ ਸਾਰਾ ਕੁਛ ਇਸ ਤੋਂ ਬਾਅਦ ਸਾਡੇ ਇਹ ਯੂ ਪੀ ਬਿਹਾਰ ਦੇ ਲੋਕ ਹੁਣ ਇੱਥੇ ਛੱਠ ਪੂਜਾ ਕਰਨਗੇ ਛੱਠ ਪੂਜਾ ਵਿੱਚ ਵੀ ਲੋਕ ਬਹੁਤ ਦਾਨ ਕਰਦੇ ਹਾਂ ਔਰ ਬਹੁਤ ਵਧੀਆ ਨਾਲ ਮਨਾਉਂਦੇ ਹਾਂ ਛੱਠ ਪੂਜਾ ਦਾ ਤਿਉਹਾਰ ਫਿਰ ਉਹ ਤੋਂ ਬਾਅਦ ਲੋਹੜੀ ਮਨਾਉਂਦੇ ਹਾਂ ਲੋਹੜੀ ਤੋਂ ਬਾਅਦ ਹੁਣ ਉਹ ਹਾਂ ਗਈ ਲੋਹੜੀ ਅਤੇ ਆਪਣੇ ਕੁੜੀਆਂ ਵਾਸਤੇ ਬਈ ਬ ਲੋਹੜੀ ਦਿੰਦ ਘਰ ਜਾ ਕੇ ਦੇ ਕੇ ਆਉਂਦੇ ਹਨ ਫਿਰ ਉਸ ਤੋਂ ਬਾਅਦ ਫਿਰ ਹੋਲੀ ਆ ਜਾਂਦੀ ਹੈ ਹੋਲੀ ਵੀ ਰੰਗਾਂ ਦਾ ਤਿਉਹਾਰ ਹੈ ਸਾਡੇ ਸਾਡਾ ਔਰ ਬਹੁਤ ਚੰਗੀ ਤਰ੍ਹਾਂ ਹੋ ਹੋਲੀ ਵੀ ਮਤਲਬ ਬਹੁਤ ਵਧੀਆ ਰੰਗੇ ਦੇ ਰੰਗ ਦੇ ਨਾਲ ਹੁੰਦੀ ਹੈ ਲੋਕ ਬਹੁਤ ਇੱਥੇ ਸਾਡੇ ਖੇਤਰ ਵਿੱਚ ਬਹੁਤ ਵਧੀਆ ਵਧੀਆ ਦੁਸਹਿਰਾ ਆ ਗਿਆ ਗਣੇਸ਼ ਜੀ ਦੀ ਪੂਜਾ ਹੁੰਦੀ ਹੈ ਦੁਸਹਿਰੇ ਵਿੱਚ ਤਾਂ ਇੱਥੇ ਜਾਗਰਨ ਵੀ ਹੁੰਦੇ ਹਨ ਸਾਰਾ ਰਾਮਲੀਲਾ ਵੀ ਚੱਲਦੀ ਹੈ ਬਹੁਤ ਇੱਥੇ ਦਾ ਬਹੁਤ ਵਧੀਆ ਵਧੀਆ ਤਿਉਹਾਰ ਮਨਾਏ ਜਾਂਦੇ ਹਨ ਸਾਡੇ ਖੇਤਰ ਵਿੱਚ ਫਿਰ ਵਿਸਰਜਨ ਵੀ ਹੁੰਦਾ ਸ਼ਿਵਰਾਤਰੀ ਵੀ ਆਉਂਦੀ ਹੈ ਬਹੁਤ ਮਤਲਬ ਬਹੁਤ ਵਧੀਆ ਹੈ ਮਤਲਬ ਸਾਡਾ ਕਲਚਰ ਬਹੁਤ ਵਧੀਆ ਹੈ ਸਾ ਅਸੀਂ ਤਾਂ ਗਰਵ ਕਰਦੇ ਹਾਂ ਵੀ ਕੀ ਸਾਡਾ ਇੰਨੇ ਅਸੀਂ ਵਧੀਆ ਕਲਚਰ ਵਿੱਚ ਪੈਦਾ ਹੋਏ ਹਾਂ ਸਾਨੂੰ ਹਰ ਚੀਜ਼ ਦੀ ਆਜ਼ਾਦੀ ਮਿਲ ਰਹੀ ਹੈ ਮਨਾਉਣ ਦੀ ਹੈ ਪੂਜਾ ਦੀਵਾਲੀ ਹੋਲੀ ਦੁਸਹਿਰਾ ਸਾਰਾ ਕੁਛ ਬਹੁਤ ਵਧੀਆ ਹੈ ਫਿਰ ਬਹੁਤ ਬੱਚਿਆਂ ਨੂੰ ਵੀ ਬਹੁਤ ਮਜ਼ਾ ਆਉਂਦਾ ਸਾਡੇ ਹੈ ਉਹਨਾਂ ਨੂੰ ਵੀ ਪਤਾ ਹੈ ਵੀ ਕੀ ਸਾਡਾ ਇਹ ਕਲਚਰ ਹੈ ਸਾਰੇ ਬੱਚੇ ਉਹਨੂੰ ਉਤਸ਼ਾਹਿਤ ਹੁੰਦਾ ਹੈ ਤਿਉਹਾਰ ਤੋਂ ਪਹਿਲੇ ਖੁਸ਼ ਹੁੰਦੇ ਆ ਇਹ ਤਿਉਹਾਰ ਆਉਣ ਵਾਲਾ ਇਹ ਤਿਉਹਾਰ ਆਉਣ ਵਾਲਾ ਹੈ